ਖਰੜ ਵਿੱਚ ਰਿਆਤ ਬਹਾਰਾ ਯੂਨੀਵਰਸਿਟੀ ਹੈ ਜਿਸ ਵਿੱਚ ਅਸੀਂ ਪੜ੍ਹਦੇ ਹਨ ਅਸੀਂ ਨਹੀਂ ਕਈ ਹੋਰ ਵੀ ਬੱਚੇ ਪੜ੍ਹਦੇ ਹਨ ਇਹਨਾਂ ਵਿੱਚ ਹੋਸਟਲ ਨੇ ਮੈਸ ਨੇ ਵਧੀਆ ਪੜ੍ਹਾਈ ਦਾ ਸੰਬੰਧ ਹੈ ਸੰਸਥਾ ਹੈ ਜੇ ਕਈ ਬੱਚੇ ਦੂਰ ਦੂਰ ਤੋਂ ਆਉਂਦੇ ਕਈ ਇੰਟਰਨੈਸ਼ਨਲ ਬੱਚੇ ਹੈ ਜਿਵੇਂ ਕਿ ਇਹੀ ਨਹੀਂ ਕੋਲਜ ਯੂਨੀਵਰਸਿਟੀ ਐੱਲ ਪੀ ਯੂ ਹੈ ਚੰਡੀਗੜ੍ਹ ਯੂਨੀਵਰਸਿਟੀ ਇਹਨਾਂ ਵਿੱਚ ਵੀ ਹੋਸਟਲ ਨੇ ਮੈਸ ਨੇ ਕੰਟੀਨ ਨੇ ਇਹਨਾਂ ਵਿੱਚ ਕਈ ਬੱਚੇ ਦੂਰ ਦੂਰ ਤੋਂ ਆਏ ਨੇ ਸਾਡੇ ਸਾਡੇ ਇੰਡੀਆ ਜਾਂ ਪੰਜਾਬ ਵਿੱਚ ਬਹੁਤ ਵਧੀਆ ਪੜ੍ਹਾਈ ਦਾ ਸ ਸਾਧਨ ਹੈ ਜਿਸ ਕਾਰਨ ਅਸੀਂ ਬਹੁਤ ਬੰਦੇ ਪੜ੍ਹ ਕੇ ਵਧੀਆ ਜੋ ਨੌਕਰੀਆਂ ਪਾ ਰਹੇ ਹਨ ਇਹ ਬਹੁਤ ਇਹ ਯੂਨੀਵਰਸਿਟੀ 'ਚ ਕੋਈ ਵੀ ਬੱਚਾ ਜਾ ਪੜ੍ਹ ਕੇ ਨਿਕਲ ਗਿਆ ਇੱਦਾਂ ਨਹੀਂ ਕੋਈ ਫੇਲ ਹੋ ਸਕਦਾ ਹੈ ਇੱਥੇ ਦੀ ਪੜ੍ਹਾਈ ਸੰਸਥਾ ਬਹੁਤ ਵਧੀਆ ਕੇਅਰ ਬਹੁਤ ਵਧੀਆ ਅਤੇ ਹਰੇਕ ਯੂਨੀਵਰਸਿਟੀ ਵਿੱਚ ਬਾਹਰ ਦਾ ਫੋਰਨ ਸਟੂਡੈਂਟ ਆਏ ਵੇ ਹੈ